ਮੈਂ ਬਚਪਨ ਤੋਂ ਹੀ ਖੇਡਾਂ ਦਾ ਸ਼ੌਕੀਨ ਹਾਂ ਜਿਵੇਂ ਕਿ ਸਾਡੇ ਸਕੂਲਾਂ ਵਿੱਚ ਖੇਡਾਂ ਟੂਰਨਾਮੈਂਟ ਕਬੱਡੀ ਕੱਪ ਕਰਵਾਏ ਜਾਂਦੇ ਹਨ ਜਾਂਦੇ ਆ ਉਸੇ ਨਾਲ ਸਾਨੂੰ ਹਰ ਇੱਕ ਇਹਦੇ ਵੀ ਸਾਨੂੰ ਹਰ ਇੱਕ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ ਮੈਨੂੰ ਸ਼ੁਰੂ ਤੋਂ ਹੀ ਕਬੱਡੀ ਦਾ ਬਹੁਤ ਸ਼ੌਕ ਸੀ ਅਤੇ ਅੱਜ ਮੈਂ ਕਈ ਟੂਰਨਾਮੈਂਟ 'ਤੇ ਕਈ ਇਨਾਮ ਜਿੱਤ ਚੁੱਕਾ ਹਾਂ ਸਟੇਟ ਲੈਵਲ ਤੋਂ ਨੈਸ਼ਨਲ ਤੱਕ ਖੇਡ ਚੁੱਕਾ ਹਾਂ ਅਤੇ ਅੱਗੇ ਮੈਂ ਇੰਟਰਨੈਸ਼ਨਲ ਲੈਵਲ 'ਤੇ ਵੀ ਖੇਡਾਂਗਾ ਜੋ ਕਿ ਮੈਨੂੰ ਸਰਕਾਰ ਵੱਲੋਂ ਕਈ ਸਹੂਲਤਾਂ ਮਿਲ ਵੀ ਮਿਲਿੰਗ ਪ੍ਰਾਪਤ ਹੋਣਗੀਆਂ ਅਤੇ ਮੈਂ ਮੈਨੂੰ ਸਰਕਾਰੀ ਨੌਕਰੀ ਵੀ ਮਿਲੇਗੀ ਕਈ ਤਰ੍ਹਾਂ ਦੇ ਇਨਾਮ ਕਈ ਤਰ੍ਹਾਂ ਦੇ ਕੱਪ ਜਿੱਤ ਚੁੱਕਾ ਹਾਂ